ਖੇਡਾਂ ਖੇਡਣ ਦੇ ਬਹੁਤ ਸਾਰੇ ਲਾਭ ਹਨ ਪੇਂਡੂ ਖੇਤਰ ਵਿੱਚ ਜਦੋਂ ਲੋਕ ਖੇਡਾਂ ਖੇੇਡਦੇ ਹਨ ਤਾਂ ਉਹਨਾਂ ਦੀ ਇੱਕ ਆਪਸ ਵਿੱਚ ਗੱਲਬਾਤ ਹੁੰਦੀ ਹੈ ਅਤੇ ਦੂਜਾ ਸਰੀਰ ਚੰਗੀ ਤਰ੍ਹਾਂ ਤੰਦਰੁਸਤ ਰਹਿੰਦਾ ਹੈ ਤੀਜਾ ਖੇਤੀਬਾੜੀ ਦੇ ਨਾਲ ਸੰਬੰਧਿਤ ਹੋਣ ਕਾਰਨ ਪੇਂਡੂ ਲੋਕ ਜੁੱਸਿਆ ਦੇ ਤਕੜੇ ਹੁੰਦੇ ਹਨ ਅਤੇ ਕੁਸ਼ਤੀ ਅਤੇ ਕਬੱਡੀ ਖੇਡਣ ਦੇ ਨਾਲ ਉਹਨਾਂ ਦਾ ਸਰੀਰ ਖੇਤੀਬਾੜੀ ਦੇ ਹੋਰ ਕਾਬਲ ਹੋ ਜਾਂਦਾ ਹੈ